ਪੰਜਾਬ ਦੇ ਵਿੱਚ ਬੈਂਕਿੰਗ ਨਾਲ ਰਿਲੇਟਡ ਕਈ ਸਾਰੀਆਂ ਓਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਕਿ ਜਿਹੜੇ ਵੀ ਪੇਸ਼ੇ ਪੇਸ਼ੇਵਰ ਜਾਂ ਪ੍ਰੋਫੈਸ਼ਨਲ ਹੈਗੇ ਹੈ ਜਾਂ ਜਿਹੜੇ ਰੈਗੂਲੇਟਰ ਹੈ ਉਨ੍ਹਾਂ ਨੂੰ ਇਕੱਠੀਆਂ ਕਰਦੀਆਂ ਹੈ ਜਿਵੇਂ ਕਿ ਪਿੱਛੇ ਜਿਹੇ ਇੱਕ ਕੋਨਫਰੈਂਸ ਵੀ ਹੋਈ ਸੀ ਜਿਹਨੂੰ ਇੰਟਰਨੈਸ਼ਨਲ ਕੋਨਫਰੈਂਸ ਨੂੰ ਗਲੋਬਲ ਬਿਜਨਸ ਕਿਹਾ ਸੀਗਾ ਉਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੈ ਪ੍ਰੋਫੈਸ਼ਨਲ ਜਾਂ ਹੋਰ ਰੈਗੂਲੇਟਰੀ ਅਥੋਰਟੀਜ ਹੈ ਉਹ ਇਕੱਠੀਆਂ ਹੋਈਆਂ ਸੈ ਸਨ ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਨਾਬਾਰਡ ਹੈ ਇੱਕ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਡਿਵੈਲਪਮੈਂਟ ਇੱਕ ਸਿਡਵੀ ਹੈ ਜਿਹਨੂੰ ਸਮੋਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਓਫ ਇੰਡੀਆ ਕਹਿੰਦੇ ਨੇ ਇੱਕ ਆਈ ਡੀ ਬੀ ਆਈ ਹੈ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਓਫ ਇੰਡੀਆ ਜਿਹੜਾ ਕਿ ਥੋੜ੍ਹੇ ਜ਼ਿਆਦਾ ਵੱਡੇ ਸਾਈਜ ਦੀ ਲਾਰਜ ਇੰਡਸਟਰੀ ਨੂੰ ਡੀਲ ਕਰਦਾ ਹੈ ਤਾਂ ਇਹ ਸਾਡੀਆਂ ਜਿਹੜੀਆਂ ਵੀ ਪੰਜਾਬ ਦੀਆਂ ਓਰਗੇਨਾਈਜੇਸ਼ਨਸ ਹੈਗੀਆਂ ਹੈ ਇਹ ਨਿਯਮ ਵੀ ਬਣਾਉਂਦੀਆਂ ਨੇ ਸਮੇਂ ਸਮੇਂ 'ਤੇ ਕੋਨਫਰੈਂਸ ਜਾਂ ਪ੍ਰੋਗਰਾਮ ਵੀ ਕਰਵਾਉਂਦੀਆਂ ਨੇ ਅਤੇ ਇਹ ਜਿੰਨੀ ਵੀ ਇੰਡਸਟਰੀਆਂ ਫੈਕਟਰੀਆਂ ਉਦਯੋਗ ਜਿਹੜੇ ਵੀ ਹੈਗੇ ਹੈ ਉਨ੍ਹਾਂ ਨਾਲ ਸਬੰਧ 'ਚ ਜੋ ਨਿਯਮ ਕਾਨੂੰਨ ਬਣਾਉਂਦੇ ਨੇ ਉਹ ਫਿਰ ਉਨ੍ਹਾਂ ਨੂੰ ਮੰਨਣੇ ਪੈਂਦੇ ਨੇ ਤਾਂ ਇਸ ਤਰੀਕੇ ਨਾਲ ਇਹ ਜਿਹੜੀਆਂ ਰਾਸ਼ਟਰੀ ਸਤਰ ਦੀਆਂ ਜਿਹੜੀਆਂ ਇਕਾਈਆਂ ਹਨ ਇਹ ਉਨ੍ਹਾਂ ਨੂੰ ਜਿੰਨੇ ਵੀ ਕਾਰਖਾਨੇ ਉਦਯੋਗ ਨੇ ਉਨ੍ਹਾਂ ਨੂੰ ਕੰਟਰੋਲ ਕਰਦੀਆਂ ਹਨ ਅਤੇ ਇਨ੍ਹਾਂ ਦੇ ਇੱਕ ਮਹੱਤਵਪੂਰਨ ਜਿਹੜਾ ਯੋਗਦਾਨ ਹੈਗਾ ਧੰਨਵਾਦ